ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਰ ਮੈਂ ਅਮਨ ਦਾ ਫਾਦਰ ਬੋਲ ਰਿਹਾ

ਓਕੇ ਸਰ ਪਰ ਮੇਰੀ ਕੁੜੀ ਤਾਂ ਮੈਨੂੰ ਦੱਸ ਰਹੀ ਸੀ ਕਿ ਉਹਦੇ ਸਾਰੇ ਲੈਕਚਰ ਕੰਪਲੀਟ ਹੈਗੇ ਨੇ ਠੀਕ ਹੈ ਸਰ ਕੋਈ ਗੱਲ ਨਹੀਂ ਜੇਕਰ ਐਕਸਟਰਾ ਲੈਕਚਰ ਲਗਾਉਣ ਦੀ ਲੋੜ ਹੈਗੀ ਆ ਮੇਰੀ ਕੁੜੀ ਨੂੰ ਤਾਂ ਤੁਸੀਂ ਲਵਾ ਲਉ ਸਮੇਂ ਦੀ ਕੋਈ ਪਰਵਾਹ ਨਹੀਂ ਬਸ ਮੇਰੀ ਕੁੜੀ ਦੇ ਮਾਰਕਸ ਵਧੀਆ ਆਉਣੇ ਚਾ ਚਾਹੀਦੇ ਨੇ ਠੀਕ ਹੈ ਸਰ ਅਗਲੇ ਹਫਤੇ ਤੋਂ ਠੀਕ ਹੈ ਸਰ ਧੰਨਵਾਦ